ਭੰਗੜੇ ਐਰੋਬਿਕਸ ਦੇ ਬਹੁਤ ਫ਼ਾਇਦੇ ਨੇ ਇਸ ਨਾਲ ਸਰੀਰ ਦੀ ਪੂਰੀ ਐਕਸਰਸੈਜ ਹੁੰਦੀ ਹੈ ਬੱਚੇ ਖੁੱਲ੍ਹ ਕੇ ਭੰਗੜਾ ਪਾਉਂਦੇ ਨੇ ਸੰਗੀਤ ਦੀ ਵਰਤੋਂ ਕਰਨ ਨਾਲ ਭੰਗੜੇ ਦੀ ਐਕਸਰਸਾਈਜਾਂ ਕਰਦੇ ਹਾਂ ਇਸ ਨੂੰ ਦਿਲਚਸਪ ਬਣਾਉਣ ਲਈ ਪ੍ਰੋਗਰਾਮ ਰੱਖੇ ਗਏ ਨੇ ਜਿਵੇਂ ਕਿੱਟੀ ਹਾਲ ਬਣਾਏ ਜਾਂਦੇ ਉੱਥੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕੋਈ ਪਾਰਕਾਂ ਦੇ ਵਿੱਚ ਵੀ ਬੱਚਿਆਂ ਨੂੰ ਭੰਗੜਾ ਸਿਖਾਇਆ ਜਾਂਦਾ ਹੈ ਕਈ ਮੌਲਾਂ ਦੇ ਵਿੱਚ ਭੰਗੜੇ ਦੇ ਵ ਭੰਗੜੇ ਦੇ ਵਿੱਚ ਖੁਸ਼ੀ ਮਨਾਉਂਦੇ ਹਨ ਪ੍ਰੋਗਰਾਮ ਰੱਖੇ ਜਾਂਦੇ ਭੰਗੜੇ ਭੰਗੜੇ ਦੇ ਵਿਆਹ ਸ਼ਾਦੀ ਦੇ ਵਿੱਚ ਵੀ ਜਦੋਂ ਭੰਗੜੇ ਦਾ ਪ੍ਰੋਗਰਾਮ ਰੱਖਦਾ ਸਪੈਸ਼ਲ ਭੰਗੜੇ ਦੀਆਂ ਟੀਮਾਂ ਬਣ ਕੇ ਆਉਂਦੀਆਂ ਹਨ ਭੰ ਭੰਗੜਾ ਭੰਗੜੇ ਨੂੰ ਦਿਲਚਸਪ ਬਣਾਉਣ ਲਈ ਸਕੂਲਾਂ ਦੇ ਵਿੱਚ ਕੰਪਲਸਰੀ ਭੰਗੜੇ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਕੋਲਜਾਂ ਦੇ ਕੋਲਜ ਦੇ ਵਿੱਚ ਵੀ ਭੰਗੜਾ ਸਿਖਾਇਆ ਜਾਂਦਾ ਹੈ ਭੰਗੜੇ ਦੀ ਮੋਢੀ ਟੀਮਾਂ ਨੂੰ ਅੱਗੇ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਜੋ ਕਿ ਬੱਚੇ ਜਿੱਤ ਕੇ ਬਹੁਤ ਇਨਾਮ ਹਾਸਿਲ ਕਰਦੇ ਹਨ ਭੰਗੜੇ ਦੀਆਂ ਟੀਮਾਂ ਅੱਗੇ ਜਾ ਕੇ ਬਹੁਤ ਵੱਡੀਆਂ ਵੱਡੀਆਂ ਟੀਮਾਂ ਬਣਦੀਆਂ ਨੇ ਜੋ ਕਿ ਦੇਖਣਯੋਗ ਟੀਮਾਂ ਹੁੰਦੀਆਂ ਹਨ ਭੰਗੜਾ ਬਹੁਤ ਬਹੁਤ ਜ਼ਰੂਰੀ ਹੈ ਸਰੀਰ ਦੇ ਲਈ ਇਹਦੇ ਨਾਲ ਡਾਂਸ ਕਰਨ ਨਾਲ ਸਰੀਰ ਨੂੰ ਤਾਕਤਾਂ ਵੀ ਮਿਲਦੀਆਂ ਹਨ